ਪੰਜ ਹਜ਼ਾਰ ਨੌ ਸੌ ਨੜੇਨਵੇਂ ਦਸ ਹਜ਼ਾਰ ਇੱਕ ਸੌ ਪੱਚੀ ਪਚਵੰਜਾ ਨੌ ਹਜ਼ਾਰ ਨੌ ਸੌ ਨੜੇਨਵੇਂ ਇੱਕ ਲੱਖ ਦਸ ਹਜ਼ਾਰ ਇੱਕ ਸੌ ਇੱਕੀ